ਬਚਪਨ ਤੋਂ ਹੀ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਉਦੋਂ ਤੋਂ ਹੀ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਕ ਸੀ ਅਤੇ ਮੈਂ ਬਹੁਤ ਸਾਰੀਆਂ ਪੇਂਟਿੰਗਾਂ ਹੁਣ ਤੱਕ ਕੀਤੀਆਂ ਹਨ ਮੈਨੂੰ ਪੈਨਸਲ ਅਤੇ ਸਕੈਚਿੰਗ ਦੋਨਾਂ ਨਾਲ ਹੀ ਪੇਂਟਿੰਗ ਸੌਖੀ ਲੱਗਦੀ ਹੈ ਕਿਉਂਕਿ ਇਹ ਮੇਰਾ ਪੈਸ਼ਨ ਹੈ ਅਤੇ ਚੰਗੀਆਂ ਚੰਗੀਆਂ ਤਸਵੀਰਾਂ ਬਣਾਉਣੀਆ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਪੈਨਸਿਲ ਨਾਲ ਥੋੜ੍ਹੀ ਜਿਹੀ ਫਿਨਿਸ਼ਿੰਗ ਜ਼ਿਆਦਾ ਆ ਜਾਂਦੀ ਹੈ ਸਕੈਚਿੰਗ ਨਾਲ ਥੋੜ੍ਹੀ ਜਿਹੀ ਪੇਂਟਿੰਗ ਜ਼ਿਆਦਾ ਰੰਗੀਨ ਅਤੇ ਆਕਰਸ਼ਿਤ ਹੋ ਜਾਂਦੀ ਹੈ ਜਿਹਦੇ ਨਾਲ ਉਹਦਾ ਮੁੱਲ ਵਧ ਜਾਂਦਾ ਹੈ ਪਰ ਪੈਨਸਿਲ ਨਾਲ ਦੇਖਿਆ ਜਾਵੇ ਤਾਂ ਉਹਦੇ ਨਾਲ ਵੀ ਪੇਂਟਿੰਗ ਬਹੁਤ ਸੋਹਣੀ ਬਣਦੀ ਹੈ ਉਹਦੇ ਨਾਲ ਆਪਾਂ ਛੋਟੀਆਂ ਛੋਟੀਆਂ ਬਾਰੀਕੀਆਂ ਦੇ ਨਾਲ ਬੰਦੇ ਦੀ ਤਸਵੀਰ ਅਤੇ ਡਿਟੇਲਾਂ ਬਣਾ ਸਕਦੇ ਹਾਂ ਇਸ ਕਰਕੇ ਮੇਰਾ ਓਪੀਨੀਅਨ ਇਹੀ ਹੈ ਕਿ ਪੈਂਸਿਲ ਅਤੇ ਸਕੈਚਿੰਗ ਦੋਨਾਂ ਨਾਲ ਹੀ ਪੇਂਟਿੰਗ ਬਹੁਤ ਵਧੀਆ ਅਤੇ ਵਧੇਰੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਧੰਨਵਾਦ